ਮੇਰਾ ਨਾਮ ਮਹਿਕਦੀਪ ਸਿੰਘ ਹੈ ਕੀ ਤੁਸੀਂ ਦੀਪ ਢਾਬਾ ਤੋਂ ਗੱਲ ਕਰ ਰਹੇ ਹੋ ਕੁਝ ਟਾਈਮ ਪਹਿਲਾਂ ਮੈਂ ਇੱਕ ਪਾਰਟੀ ਰੱਖੀ ਸੀ ਅਤੇ ਉਸਦੇ ਲਈ ਮੈਨੇ ਕੁਝ ਔਡਰ ਵੀ ਦਿੱਤੇ ਸਨ ਕੁਝ ਰੀਜ਼ਨ ਦੇ ਕਾਰਨ ਉਹ ਔਡਰ ਵਿੱਚੋਂ ਮੈਨੂੰ ਕੁਝ ਔਡਰ ਘੱਟ ਕਰਨੇ ਪੈ ਰਹੇ ਹਨ ਕਿਉਂਕਿ ਪਹਿਲਾਂ ਤਾਂ ਪਰਸਨ ਦੀ ਮਾਤਰਾ ਬਹੁਤ ਬਹੁਤ ਜ਼ਿਆਦਾ ਸੀ ਅਤੇ ਹੁਣ ਕੁਝ ਰੀਜਨ ਕਰਕੇ ਮੈਨੂੰ ਘਟਾਉਣਾ ਪੈ ਰਿਹਾ ਹੈ ਕਿ ਤੁਸੀਂ ਉਹਨਾਂ ਵਿੱਚੋਂ ਕੁਝ ਆਈਟਮ ਦੀ ਮਾਤਰਾ ਨੂੰ ਘੱਟ ਕਰ ਸਕਦੇ ਹੋ ਅਤੇ ਕੁਝ ਆਈਟਮਸ ਨੂੰ ਵੀ ਘੱਟ ਕਰ ਸਕਦੇ ਹੋ ਜਿਵੇਂ ਕਿ ਦੋ ਚਪਾਤੀਆਂ ਦੀ ਬਜਾਏ ਤੁਸੀਂ ਇੱਕ ਚਪਾਤੀ ਕੁਝ ਬਟਰ ਦੀ ਬਜਾਏ ਥੋੜ੍ਹੇ ਹੋਰ ਘੱਟ ਅਤੇ ਕੁਝ ਜਿਵੇਂ ਕਿ ਮੈਂ ਪੰਜ ਕਿਲੋ ਚਿਕਨ ਦੇ ਦਿੱਤਾ ਔਡਰ ਦਿੱਤਾ ਸੀ ਅਤੇ ਹੁਣ ਉਹਦੇ ਵਿੱਚੋਂ ਢਾਈ ਕਿਲੋ ਚਿਕਨ ਦੀ ਹੀ ਮਾਤਰਾ ਦੇਣੀ ਹੈ ਕੀ ਤੁਸੀਂ ਇਹ ਸਾਰੀਆਂ ਆਈਟਮਸ ਨੂੰ ਸਹੀ ਤਰੀਕੇ ਨਾਲ ਮੈਨਟੇਨ ਕਰ ਸਕਦੇ ਹੋ ਪਾਰਟੀ ਵਿੱਚ ਕਾਫੀ ਚੀਜ਼ਾਂ ਸਕਿੱਪ ਵੀ ਕਰਨੀਆਂ ਹਨ ਅਤੇ ਕਾਫੀ ਐਡ ਔਨ ਵੀ ਕਰਨੀਆਂ ਹਨ